ਗਾਇਕੀ ਵਿੱਚ ਗਤੀਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ ਗਤੀਸ਼ੀਲਤਾ ਵਿੱਚ ਅਸੀਂ ਵਾਕੰਸ਼ ਨੂੰ ਇਸ ਤਰ੍ਹਾਂ ਇਸਤੇਮਾਲ ਕਰਦੇ ਹਾਂ ਕਿ ਕੁਝ ਗੀਤ ਅਜਿਹੇ ਬਣਾਏ ਜਾਂਦੇ ਹਨ ਜਿਹਨਾਂ ਦਾ ਕੁਝ ਵੀ ਮਤਲਬ ਨਹੀਂ ਹੁੰਦਾ ਜਿਹਨੂੰ ਆਪਾਂ ਬੇਫ਼ਜ਼ੂਲ ਕਹਿ ਸਕਦੇ ਹਾਂ ਅਤੇ ਜਿਹਨਾਂ ਤੋਂ ਲੋਕਾਂ ਨੂੰ ਕੁਝ ਵੀ ਸਿੱਖਣ ਨੂੰ ਨਹੀਂ ਮਿਲਦਾ ਉਲਟਾ ਉਹਨਾਂ ਵਿੱਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਹਨ ਇਸ ਲਈ ਵਾਕੰਸ਼ ਨੂੰ ਸਹੀ ਤਰੀਕੇ ਨਾਲ ਆਪਣੀ ਗਾਇਕੀ ਵਿੱਚ ਇਸਤੇਮਾਲ ਕਰਨ ਲਈ ਉਸ ਦੀ ਪੂਰੀ ਵਿਆਖਿਆ ਸਹੀ ਤਰੀਕੇ ਨਾਲ ਕਰਕੇ ਹੀ ਚੰਗੀ ਗਾਇਕੀ ਦੀ ਇੱਕ ਮਿਸਾਲ ਦੇ ਸਕਦੇ ਹਾਂ